ਸਤਿ ਸ਼੍ਰੀ ਅਕਾਲ ਸਰ ਮੈਂ ਹਰਜੀਤ ਕੌਰ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਂ ਤੁਹਾਡੇ ਕੈਬ ਬੁੱਕ ਕਰਵਾਈ ਸੀ ਜਿਸਦਾ ਕੋਈ ਹਜ਼ਾਰ ਪੰਦਰਾਂ ਸੌ ਰੁਪਈਆ ਅਸੀਂ ਬੁੱ ਦਿੱਤਾ ਸੀ ਅਤੇ ਮੈਂ ਚਾਹੁੰਦੀ ਹਾਂ ਕਿ ਤੁਹਾਡਾ ਡਰਾਈਵਰ ਸਾਡੇ ਕੋਲ ਜਲਦੀ ਪਹੁੰਚ ਜਾਵੇ ਕਿਉਂਕਿ ਅਸੀਂ ਸ਼ਗਨ ਦੇ ਪ੍ਰੋਗਰਾਮ 'ਤੇ ਵੀ ਜਾਣਾ ਹੈ ਅਤੇ ਅਸੀਂ ਮੈਰਿਜ ਵੀ ਅਟੈਂਡ ਕਰਨੀ ਹੈ ਕੁਛ ਸਾਡੇ ਕੋਲ ਸਮਾਨ ਵੀ ਹੈ ਕੁਛ ਕਿੱਟਾਂ ਵੀ ਹੈ ਕੁਛ ਮੇਕਅਪ ਦਾ ਸਮਾਨ ਵੀ ਹੈ ਨਾਲ ਸਾਡੇ ਛੋਟੇ ਬੱਚੇ ਵੀ ਹਨ ਮੇਰੀਆਂ ਬੇਟੀਆਂ ਵੀ ਹਨ ਅਸੀਂ ਜਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਟਾਈਮ ਸਿਰ ਜਾਈਏ ਜਲਦੀ ਜਾਈਏ ਕਿਉਂਕਿ ਸਾਡੇ ਕੋਲ ਹਨੇਰਾ ਨਾ ਹੋ ਜਾਵੇ ਅਤੇ ਅਸੀਂ ਟਾਈਮ ਸਿਰ ਅਸੀਂ ਪੁੱਜ ਜਾਈਏ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਡਰਾਈਵਰ ਜਲਦੀ ਭੇਜੋ ਤਾਂ ਕੋ ਅਸੀਂ ਸ਼ਗਨ ਦਾ ਪ੍ਰੋਗਰਾਮ ਵੀ ਅਟੈਂਡ ਕਰ ਸਕੀਏ ਵਿਆਹ ਦਾ ਵੀ ਕਰ ਸਕੀਏ ਅਤੇ ਅਸੀਂ ਟਾਈਮ ਸਿਰ ਜਾਈਏ ਅਤੇ ਟਾਈਮ ਸਿਰ ਹੀ ਵਾਪਿਸ ਆਈਏ ਤੁਸੀਂ ਹੁਣ ਦੱਸੋ ਤੁਸੀਂ ਆਪਣਾ ਡਰਾਈਵਰ ਸਾਡੇ ਕੋਲ ਕਦੋਂ ਭੋ ਹਾਂ ਅਸੀਂ ਸਾ ਆਪਣਾ ਡਰਾਈਵਰ ਤੁਸੀਂ ਸਾਡੇ ਕੋਲ ਕਦੋਂ ਭੇਜੋਗੇ ਤਾਂ ਕਿ ਅਸੀਂ ਜਲਦੀ ਪਹੁੰਚੀਏ ਅਤੇ ਆਪਣਾ ਪ੍ਰੋਗਰਾਮ ਅਟੈਂਡ ਕਰ ਸਕੀਏ